ਹੈਲੋ ਤੁਸੀਂ ਨੇ ਨੰਬਰ ਦਿੱਤਾ ਸੀ ਤੁਹਾਡਾ ਮੈਂ ਮਾਨਸਾ ਜ਼ਿਲ੍ਹੇ 'ਚ ਆਈ ਸੀ ਮੈਨੇ ਸੁਣਿਆ ਸੀ ਇੱਥੇ ਬਹੁਤ ਮੇਲੇ ਲੱਗਦੇ ਨੇ ਤਾਂ ਮੈਂ ਅੱਛਾ ਜੀ ਹਾਂਜੀ

ਠੀਕ ਹੈ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਮੈਂ ਵੀ ਸੁਣਿਆ ਵੀ ਬਹੁਤ ਦੂਰ ਦੂਰ ਤੋਂ ਅਉਂਦੇ ਨੇ ਜੀ ਕਰਨ ਅਤੇ ਹਾਂਜੀ ਬਸੰਤ ਪੰਚਮੀ 'ਤੇ ਲੱਗਦੀ ਮੇਲਾ ਲੱਗਦਾ ਹੈ ਨਾ ਜੀ ਹਾਂਜੀ ਸੁਣਿਆ ਸੀ ਮੈਂ ਵੀ ਆਪਦੇ ਮਤਲਬ ਰਿਸ਼ਤੇਦਾਰਾਂ ਤੋਂ ਸੁਣਿਆ ਸੀ ਵੀ ਬਹੁਤ ਦੂਰ ਦੂਰ ਤੋਂ ਆਉਂਦੇ ਨੇ ਜੀ ਇੱਥੇ ਮੱਥਾ ਟੇਕਣ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮਤਲਬ ਜੀ ਪੂਰਾ ਸੱਭਿਆਚਾਰਕ ਪ੍ਰੋਗਰਾਮ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਜੀ